ਪੰਜਾਬੀ ਵਿੱਚ ਬਹੁਤ ਸਾਰੇ ਸ਼ਬਦ ਹਨ ਜੋ ਮੈਨੂੰ ਪਸੰਦ ਹਨ ਜਿਵੇਂ ਕਿ ਪਿਆਰ ਮਿਲਵਰਤਨ ਖੁਸ਼ੀ ਹੁਲਾਰਾ ਇਹ ਸ਼ਬਦ ਮੈਨੂੰ ਬਹੁਤ ਹੀ ਪਸੰਦ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਕੁਛ ਵਾਕੰਸ਼ ਹਨ ਜੋ ਕਿ ਮੈਂ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਸ਼ਾਮਿਲ ਕਰਦਾ ਹਾਂ ਜਿਵੇਂ ਕਿ ਕੀ ਹਾਲ ਹੈ ਤੁਹਾਡਾ ਤੁਸੀਂ ਅੱਜ ਕੱਲ੍ਹ ਕਿੱਥੇ ਰਹਿੰਦੇ ਹੋ ਇਵੇਂ ਦੇ ਜੋ ਵਾਕੰਸ਼ ਹਨ ਉਹ ਰੋਜ਼ਾਨਾ ਨਿਤਾ ਪ੍ਰਤੀ ਜੀਵਨ ਵਿੱਚ ਮੈਂ ਵਰਤਦਾ ਰਹਿੰਦਾ ਹਾਂ ਅਤੇ ਪੰਜਾਬੀ ਦਾ ਬੁਲਾਰਾ ਹੋਣ ਦਾ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਅਤੇ ਜਦੋਂ ਕਿਸੇ ਨਾਲ਼ ਵੀ ਮੈਂ ਪੰਜਾਬੀ ਵਿੱਚ ਗੱਲ ਕਰਦਾ ਹਾਂ ਅਤੇ ਉਹ ਬਹੁਤ ਮੇਰੇ ਤੋਂ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਉਹ ਮੇਰੀ ਪੰਜਾਬੀ ਦੇਖ ਕੇ ਬਹੁਤ ਖੁਸ਼ ਹੁੰਦਾ ਹੈ